ਹਾਂਜੀ ਸਭ ਤੋਂ ਪਹਿਲੇ ਤਾਂ ਇਹ ਹੈ ਕਿ ਹਾਂ ਮੈਨੂੰ ਕੁੱਕ ਬੁੱਕ ਹਾਂ ਮੇਰੇ ਕੋਲ ਹੈਗੀ ਹੈ ਕਿਉਂਕਿ ਮੇਰਾ ਬਚਪਨ ਤੋਂ ਇਹ ਅਹ ਕੁਕਿੰਗ ਦੇ ਵਿੱਚ ਬਹੁਤ ਹੀ ਜ਼ਿਆਦਾ ਦਿਲਚਸਪੀ ਸੀਗੀ ਮੈਨੂੰ ਬਚਪਨ ਤੋਂ ਹੀ ਖਾਣਾ ਬਣਾਉਣਾ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਹੁੰਦਾ ਸੀ ਅਤੇ ਮੇਰੀ ਮੰਮਾ ਤੋਂ ਵੀ ਮੈਨੂੰ ਬਹੁਤ ਵਧੀਆ ਸੀਖ ਮਿਲਦੀ ਹੈ ਕਿਉਂਕਿ ਉਹ ਵੀ ਮੇਰੀ ਹਮੇਸ਼ਾ ਮਦਦ ਕਰਦੇ ਹੁੰਦੇ ਸਨ ਉਹ ਮੈਨੂੰ ਸਵਤੰਤਰ ਬਣਨਾ ਸਿਖਾਉਂਦੇ ਹੁੰਦੇ ਸਨ ਅਤੇ ਹਾਂ ਮੇਰੀ ਮੰਮਾ ਨੇ ਮੈਨੂੰ ਇੱਕ ਬੁੱ ਕੁੱਕ ਬੁੱਕ ਦਿੱਤੀ ਹੋਈ ਸੀਗੀ ਜਿਹਦੇ ਵਿੱਚੋਂ ਮੈਂ ਦੇਖ ਅਲੱਗ ਅਲੱਗ ਤਰ੍ਹਾਂ ਦੀਆਂ ਹ ਸਵੀਟ ਡਿਸ਼ਜ਼ ਵਗੈਰਾ ਦੇਖ ਕੇ ਜਿਹੜੇ ਮਿਠਾਈਆਂ ਹੁੰਦੀਆਂ ਹੈ ਜਾਂ ਕੋਈ ਹੋਰ ਤਰ੍ਹਾਂ ਦੀ ਸਬਜ਼ੀਆਂ ਆਦਿ ਵਗੈਰਾ ਸਭ ਉਹਦੇ ਵਿੱਚ ਸਭ ਕੁਛ ਦੱ ਦੱਸਿਆ ਗਿਆ ਹੋਇਆ ਫੂਡ ਬਲੋਗ ਵੀ ਮੈਂ ਯੂਟਿਊਬ 'ਤੇ ਬਹੁਤ ਹੀ ਜ਼ਿਆਦਾ ਦੇਖਦੀ ਹੁੰਦੀ ਹਾਂ ਅਹ ਸਭ ਤੋਂ ਪਹਿਲੇ ਮੈਂ ਆਪਣੇ ਲਾਈਫ ਟਾਈਮ ਸਭ ਤੋਂ ਪਹਿਲੇ ਮੈਂ ਦੇਖਿਆ ਹੋਇਆ ਸੀਗਾ ਅਹ ਕੜਾਹ ਪ੍ਰਸ਼ਾਦ ਬਣਾਉਣਾ ਕਿਉਂਕਿ ਸਾਡੇ ਘਰ ਵਿੱਚ ਇੱਕ ਰੀਤ ਹੈਗੀ ਹੈ ਜਦੋਂ ਵੀ ਆਪਾਂ ਕੋਈ ਵੀ ਚੀਜ਼ ਸਿੱਖਦੇ ਹਾਂ ਸਭ ਤੋਂ ਪਹਿਲੇ ਮਿੱਠਾ ਮਿਠਾਈ ਬਣਾਈ ਜਾਂਦੀ ਹੈ ਇਸ ਲਈ ਮੈਂ ਸਭ ਤੋਂ ਪਹਿਲੇ ਕੜਾਹ ਪ੍ਰਸ਼ਾਦ ਬਣਾਉਣਾ ਸਿੱਖਿਆ ਹੋਇਆ ਸੀ ਉਹ ਮੈਂ ਯੂਟਿਊਬ ਤੋਂ ਸਿੱਖਿਆ ਹੋਇਆ ਸੀ ਅਤੇ ਮੈਂ ਪੂਰੇ ਘਰ ਦੇ ਮੈਂਬਰਾਂ ਨੂੰ ਦਿੱਤਾ ਸੀ ਕਿਉਂਕਿ ਮੈਨੂੰ ਕੁਕਿੰਗ ਦਾ ਬਹੁਤ ਹੀ ਜ਼ਿਆਦਾ ਸ਼ੌਕ ਹੈਗਾ ਕੁੱਕ ਤਾਂ ਇੱਕ ਤਰ੍ਹਾਂ ਦੀ ਮੇਰੀ ਇੱਕ ਤਰ੍ਹਾਂ ਦੀ ਹੋਬੀ ਹੈਗੀ ਹੈ ਇਸ ਕਰਕੇ ਹਾਂ ਮੈਂ ਕੁੱਕ ਬੁੱਕ ਤੋਂ ਵੀ ਬਹੁਤ ਸਾਰੀਆਂ ਚੀਜ਼ਾਂ ਹਾਂ ਦੇਖਦੀ ਹਾਂ ਅਤੇ ਫਿਰ ਉਹਨੂੰ ਸਮਝਦੀ ਹਾਂ ਫਿਰ ਬਣਾਉਂਦੀ ਹਾਂ